ਪੰਜਾਬ ਦਾ ਸੱਭਿਆਚਾਰ ਭਾਰਤ ਦੀ ਮੁੱਖ ਧਾਰਾ ਦੇ ਸੱਭਿਆਚਾਰ ਤੋਂ ਕਾਫੀ ਵੱਖਰਾ ਹੈ ਪੰਜਾਬ ਦਾ ਇੱਕ ਆਪਣਾ ਸੱਭਿਆਚਾਰ ਹੈ ਔਰ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਵੱਖ ਵੱਖ ਧਰਮਾਂ ਦੇ ਵੱਖ ਵੱਖ ਰਿਲੀਜੀਅਸ ਦੇ ਜਿਹੜੇ ਲੋਕ ਨੇ ਉਹ ਰਹਿੰਦੇ ਨੇ ਔਰ ਉਹਨਾਂ ਸਾਰਿਆਂ ਦਾ ਵੱਖਰਾ ਵੱਖਰਾ ਜਿਹੜਾ ਆਪਣਾ ਇੱਕ ਕਲਚਰ ਹੈ ਪਰ ਜਿਹੜਾ ਪੰਜਾਬ ਹੈ ਉਹਦਾ ਆਪਣਾ ਇੱਕ ਵੱਖਰਾ ਜਿਹੜਾ ਸੱਭਿਆਚਾਰ ਹੈ ਜੇ ਸੱਭਿਆਚਾਰ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਨੂੰ ਜੰਗਾਂ ਜਾਂ ਜਿਹੜੇ ਯੁੱਧ ਨੇ ਜਿਹੜੀ ਜਦੋਂ ਉਹਨਾਂ ਦੀ ਖ਼ਬਰ ਮਿਲਦੀ ਹੈ ਤਾਂ ਉਹਨਾਂ ਦਾ ਜਿਹੜਾ ਖੂਨ ਹੈ ਉਹ ਲਲਕਾਰੇ ਮਾਰਨਾ ਸ਼ੁਰੂ ਕਰ ਦਿੰਦਾ ਹੈ ਕਿਉਂ ਕਿਉਂਕਿ ਇਹਨਾਂ ਨੂੰ ਜਿਹੜੇ ਗੁੜਤੀ ਮਿਲੀ ਹੈ ਪੰਜਾਬੀ ਕਲਚਰ ਨੂੰ ਉਹ ਹਮਲਾਵਰਾਂ ਦਾ ਸਾਹਮਣਾ ਅਸੀਂ ਕਿੱਦਾਂ ਕਰਨਾ ਹੈ ਧਾੜਵੀਆਂ ਦਾ ਸਾਹਮਣਾ ਜਿਹੜਾ ਅਸੀਂ ਕਿਸ ਤਰ੍ਹਾਂ ਕਰਨਾ ਹੈ ਇਹ ਉਹਨਾਂ ਨੂੰ ਖੂਨ 'ਚੋਂ ਹੀ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ ਤਾਂ ਪੰਜਾਬੀ ਜਿਹੜਾ ਕਲਚਰ ਹੈ ਇਹਦੇ ਵਿੱਚ ਇਹਦੀ ਦੁਨੀਆ ਦੇ ਵਿੱਚ ਜਿਹੜੀ ਵੱਖਰੀ ਪਛਾਣ ਹੈ ਇਸ ਕਰਕੇ ਪੰਜਾਬੀ ਕਲਚਰ ਨੂੰ ਸ ਸਿਰਫ਼ ਭਾਰਤ ਨਹੀਂ ਪੂਰੀ ਦੁਨੀਆ ਦੇ ਵਿੱਚ ਹੀ ਇਸ ਨੂੰ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਚਾਹੇ ਉਹ ਕਿਸੇ ਵੀ ਪਾਸੇ ਤੋਂ ਲੈ ਲਵੋ ਕੋਈ ਵੀ ਪੱਖ ਉਹਦਾ ਇਹਦੇ ਵਿੱਚ ਲੈ ਲਿਆ ਜਾਵੇ ਫੋਰ ਇਗਜਾਮਪਲ ਜਿਵੇਂ ਅਸੀਂ ਕਹਿ ਸਕਦੇ ਹਾਂ ਚਾਹੇ ਉਹ ਲੜਾਈ ਝਗੜੇ ਦੀ ਗੱਲ ਹੋਵੇ ਚਾਹੇ ਉਹ ਆਪਣਾ ਹੱਕ ਲੈਣ ਦੀ ਗੱਲ ਹੋਵੇ ਚਾਹੇ ਉਹ ਨੱਚਣ ਅਤੇ ਟੱਪਣ ਦੀ ਗੱਲ ਹੋਵੇ ਜਿਹਦੇ ਵਿੱਚ ਗਿੱਧਾ ਅਤੇ ਭੰਗੜਾ ਪੰਜਾਬੀ ਸੱਭਿਆਚਾਰ ਦੇ ਵਿੱਚ ਅਸੀਂ ਸ਼ਾਮਲ ਕਰ ਸਕਦੇ ਹਾਂ ਚਾਹੇ ਉਹ ਲੋਕ ਗੀਤਾਂ ਦੀ ਗੱਲ ਹੋ ਜਾਵੇ ਚਾਹੇ ਉਹ ਵਿਆਹ ਸ਼ਾਦੀਆਂ ਦਾ ਜਿਹੜਾ ਗਾਉਣ ਹੈ ਉਹਦੀ ਗੱਲ ਹੋ ਜਾਵੇ ਇਹ ਸਾਰਾ ਕੁਝ ਭਾਰਤ ਦੀ ਜਿਹੜੀ ਮੁੱਖ ਧਾਰਾ ਦਾ ਸੱਭਿਆਚਾਰ ਹੈ ਉਹਦੇ ਨਾਲੋਂ ਕਾਫੀ ਹੱਦ ਤੱਕ ਜਿਹੜਾ ਹੈ ਉਹ ਵੱਖਰਾ ਹੈ